ਅਸੀਂ ਆਮ ਤੌਰ 'ਤੇ ਉਮੀਦ ਕਰਦੇ ਹਾਂ ਕਿ ਸਾਡਾ ਪੰਜਾਬ ਵਧੇ ਫੁੱਲੇ ਪੰਜਾਬ ਦੇ ਅੰਦਰ ਬਹੁਤ ਜ਼ਿਆਦਾ ਤਰੱਕੀ ਹੋਵੇ ਜਿਹੜੇ ਨੌਜਵਾਨ ਹੈ ਉਹ ਨਸ਼ਿਆਂ ਵਾਲੇ ਪਾਸੇ ਨਾ ਜਾਣ ਪੰਜਾਬ ਦੇ ਜਿਹੜੇ ਨੌਜਵਾਨ ਹੈ ਉਹ ਆਪਦੇ ਸੱਭਿਆਚਾਰ ਦੇ ਨਾਲ ਜੁੜਨ ਪੰਜਾਬ ਤਰੱਕੀ ਕਰੇ ਲੋਕ ਇਕੱਲੀਆਂ ਨੌਕਰੀਆਂ ਮਗਰ ਨਾ ਭੱਜਣ ਸਗੋਂ ਆਪਣਾ ਜਿਹੜਾ ਕਿੱਤਾ ਆਪਣਾ ਜਿਹੜਾ ਕਾਰੋਬਾਰ ਹੈ ਉਹ ਖੁਦ ਕਰਨ ਉਹ ਜਿਹੜਾ ਇੰਟਰਪਨੋਰ ਬਣਨ ਆਤਮ ਨਿਰਭਰ ਬਣਨ ਪਰੰਤੂ ਉਸਦੇ ਮੁਕਾਬਲੇ ਪੰਜਾਬ ਦੇ ਵਿੱਚ ਹੈਰਾਨੀਜਨਕ ਗੱਲ ਹੈ ਕਿ ਅੱਜ ਨਸ਼ਾ ਜਿਹੜਾ ਬਹੁਤ ਵੱਡੀ ਪੱਧਰ ਦੇ ਉੱਤੇ ਹੈਗਾ ਅੱਜ ਪੰਜਾਬ ਵਿੱਚ ਬੇਰੁਜ਼ਗਾਰੀ ਬਹੁਤ ਜਿਆਦਾ ਹੈਗੀ ਹੈ ਅੱਜ ਪੰਜਾਬ ਦੇ ਨੌਜਵਾਨ ਜਿਹੜੇ ਪੱਚੀ ਪੱਚੀ ਤੀਹ ਤੀਹ ਲੱਖ ਰੁਪਏ ਲਾ ਕੇ ਪੰਜਾਬ ਨੂੰ ਖਾਲੀ ਕਰ ਲਿਆ ਅਤੇ ਕਰ ਰਹੇ ਅਤੇ ਪੰਜਾਬ ਦਾ ਜਿਹੜਾ ਸਰਮਾਇਆ ਉਹ ਬਾਹਰਲੇ ਮੁਲਕਾਂ ਵੱਲ ਨੂੰ ਭੇਜ ਰਹੇ ਹੈ ਅਤੇ ਜਿਹੜੀਆਂ ਇੱਥੋਂ ਦੇ ਰਾਜ ਕਰਨ ਵਾਲੀਆਂ ਸਾਰੀਆਂ ਪਾਰਟੀਆਂ ਦੇ ਜਿਹੜੇ ਨੇਤਾ ਹੈਗੇ ਹੈ ਲੀਡਰ ਹੈਗੇ ਹੈ ਉਹਨਾਂ ਦਾ ਇਸ ਗੱਲ ਵੱਲ ਕੋਈ ਖਿਆਲ ਨਹੀਂ ਉਹਨਾਂ ਦਾ ਸਿਰਫ ਅਤੇ ਸਿਰਫ ਆਪਣੀ ਕੁਰਸੀ ਵੱਲ ਖਿਆਲ ਹੈ ਅਤੇ ਪੰਜਾਬ ਦੇ ਵਿੱਚ ਬਹੁਤ ਵੱਡੀ ਲੋੜ ਹੈ ਅੱਜ ਇਸ ਗੱਲ ਦੀ ਬਹੁਤ ਹੈਰਾਨੀ ਹੈ ਕਿ ਨੌਜਵਾਨ ਮੁੰਡਿਆਂ ਦੇ ਨਾਲ ਨਾਲ ਨੌਜਵਾਨ ਕੁੜੀਆਂ ਵੀ ਨਸ਼ਿਆਂ ਦਾ ਸੇਵਨ ਕਰ ਰਹੀਆਂ ਅਤੇ ਬਹੁਤ ਸਾਰੀਆਂ ਇਹੋ ਜਿਹੀਆਂ ਖਬਰਾਂ ਆਮ ਤੌਰ 'ਤੇ ਅਖਬਾਰਾਂ ਦੇ ਵਿੱਚ ਛਪਦੀਆਂ ਕਿ ਫਲਾਣੀ ਲੜਕੀ ਨੇ ਵੀ ਨਸ਼ੇ ਦਾ ਟੀਕਾ ਲਾਇਆ ਜਾਂ ਉਹ ਨਸ਼ੇ ਕਰ ਰਹੀ ਹੈਗੀ ਹੈ ਇਹ ਬਹੁਤ ਚਿੰਤਾ ਦਾ ਵਿਸ਼ਾ ਇਹ ਸਾਨੂੰ ਬਹੁਤ ਹੈਰਾਨ ਕਰਦਾ ਹੈ